ਮੈਨੂੰ ਇੱਕ ਸ਼ੌਕ ਦੇ ਤੌਰ 'ਤੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਕਿਉਂਕਿ ਇੱਕ ਮੰਗ ਵਾਲੇ ਕੰਮ ਦੀ ਸਮਾਂ ਸਾਰਣੀ ਨਾਲ ਜੂਝਣਾ ਅਤੇ ਰੋਜ਼ਾਨਾ ਜੀਵਨ ਦੇ ਲਗਾਤਾਰ ਦਬਾਅ ਤੋਂ ਪ੍ਰਭਾਵਿਤ ਮਹਿਸੂਸ ਕਰਨ ਤੋਂ ਬਾਅਦ ਮੈਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਸ਼ੁਰੂ ਵਿੱਚ ਮੈਂ ਸਰੀਰਕ ਸਿਹਤ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਦੀ ਪ੍ਰਤੀਸ਼ਿਸ਼ਠਤਾ ਦੁਆਰਾ ਉਤਸੁਕ ਸੀ ਪਰ ਇਹ ਨਿੱਜੀ ਸਿਫਾਰਸ਼ਾਂ ਅਤੇ ਖੋਜ ਦਾ ਸੁਮੇਲ ਸੀ ਜਿਸਨੇ ਮੈਨੂੰ ਅਸਲ ਵਿੱਚ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਯੋਗਾ ਦਾ ਅਭਿਆਸ ਕਰਨ ਵਾਲੇ ਦੋਸਤਾਂ ਅਤੇ ਪਰਿਵਾਰਾਂ ਨੇ ਇਸਦੇ ਪਰਿਵਰਤਨਸ਼ੀਲ ਪ੍ਰਭਾਵਾਂ ਬਾਰੇ ਗੱਲ ਕੀਤੀ ਇਹ ਵਰਣਨ ਕਰਦੇ ਹੋਏ ਕਿ ਕਿਵੇਂ ਇਸ ਨੇ ਉਹਨਾਂ ਨੂੰ ਹਫੜਾ ਦਫੜੀ ਦੇ ਵਿਚਕਾਰ ਸ਼ਾਂਤ ਹੋਣ ਉਹਨਾਂ ਦੇ ਫੋਕਸ ਨੂੰ ਬਿਹਤਰ ਬਣਾਉਣ ਅਤੇ ਉਹਨਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਕੀਤੀ ਇਸ ਨੇ ਮੇਰੀ ਉਤਸੁਕਤਾ ਨੂੰ ਵਧਾ ਦਿੱਤਾ ਅਤੇ ਮੈਨੂੰ ਯੋਗਾ ਦੀ ਹੋਰ ਖੋਜ ਕਰਨ ਲਈ ਪ੍ਰੇਰਿਤ ਕੀਤਾ ਮੈਂ ਕੁਝ ਸ਼ੁਰੂਆਤੀ ਕਲਾਸਾਂ ਵਿੱਚ ਭਾਗ ਲਿਆ ਅਤੇ ਸਰੀਰਕ ਮਿਹਨਤ ਅਤੇ ਮਾਨਸਿਕ ਆਰਾਮ ਦੇ ਵਿਚਕਾਰ ਸੰਤੁਲਨ ਯੋਗਾ ਪੇਸ਼ਕਸ਼ਾਂ ਦੁਆਰਾ ਤੁਰੰਤ ਪ੍ਰਭਾਵਿਤ ਹੋਇਆ ਦਿਮਾਗੀ ਸਾਹ ਲੈਣ ਅਤੇ ਸਿਮਰਨ ਅਤੇ ਅਭਿਆਸ ਦਾ ਜ਼ੋਰ ਤਣਾਅ ਦੇ ਪ੍ਰਬੰਧਨ ਅਤੇ ਸਵੈ ਜਾਗਰੂਕਤਾ ਨੂੰ ਵਧਾਉਣ ਲਈ ਇੱਕ ਸੰਪੂਰਨ ਪਹੁੰਚ ਦੀ ਮੇਰੀ ਜ਼ਰੂਰਤ ਨਾਲ ਗੂੰਜਦਾ ਹੈ ਜਿੰਨਾ ਜ਼ਿਆਦਾ ਮੈਂ ਯੋਗਾ ਵਿੱਚ ਡੂੰਘਾਈ ਨਾਲ ਜਾਣਿਆ ਓਨਾ ਹੀ ਮੈਂ ਇਹਦੇ ਦਾਰਸ਼ਨਿਕ ਧਾਰਾ ਅਤੇ ਆਪਣੇ ਆਪ ਨਾਲ ਡੂੰਘੇ ਸੰਬੰਧਾਂ ਨੂੰ ਵਧਾਉਣ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ ਸਰੀਰਕ ਲਾਭਾਂ ਮਾਨਸਿਕ ਸਪੱਸ਼ਟਤਾ ਅਤੇ ਵਿਅਕਤੀਗਤ ਪਕਾ ਦੇ ਸੁਮੇਲ ਨੇ ਅੰਤ ਵਿੱਚ ਮੈਨੂੰ ਯੋਗਾ ਨੂੰ ਇੱਕ ਸ਼ੌਕ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਇਸ ਨੂੰ ਲਚਕੀਲੇਪਣ ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਦੀ ਵਧੇਰੇ ਭਾਵਨਾ ਪੈਦਾ ਕਰਨ ਲਈ ਰੁਟੀਨ ਵਿੱਚ ਜੋੜਿਆ ਯੋਗਾ ਜੋ ਕਿ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਆ ਉਸ ਨੂੰ ਕਰਨ ਨਾਲ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ